ਹੈਲੋ ਹਾਂਜੀ ਮਿਸਟਰ ਸਟੀਫਨ ਹਾਂਜੀ ਤੁਹਾਡੀ ਨਾ ਇਸਟਾਗ੍ਰਾਮ ਦੇ ਉੱਪਰ ਮੈਨੂੰ ਰਿਕੁਐਸਟ ਸੈਂਡ ਆਈ ਸੀਗੀ ਅਤੇ ਜਿਹਦੇ ਵਿੱਚ ਤੁਸੀਂ ਮੈਨੂੰ ਇੱਕ ਕੁਸ਼ਚਨ ਪੁੱਟ ਕੀਤਾ ਹੈਗਾ ਵੀ ਵੀ ਤੁਸੀਂ ਜਿਹੜਾ ਸਾਡੇ ਬਰਨਾਲਾ ਜ਼ਿਲ੍ਹੇ ਦੇ ਜਿਹੜਾ ਸੱਭਿਆਚਾਰਕ ਅਤੇ ਸਮਾਜਿਕ ਪਰੰਪਰਾਵਾਂ ਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋਗੇ ਅਤੇ ਮੈਖਾਂ ਬਈ ਮੈਂ ਚਲ ਤੁਹਾਨੂੰ ਫੋਨ ਵੀ ਤੁਹਾਨੂੰ ਦੱਸ ਦਿੰਦਾ ਹੈਗਾ ਜਿਹੜਾ ਸਾਡਾ ਬਰਨਾਲਾ ਜ਼ਿਲ੍ਹੇ ਦੇ ਲਈ ਤੁਸੀਂ ਇੰਨੇ ਜ਼ਿਆਦਾ ਉਤਸੁਕ ਹੋਗੇ ਬਰਨਾਲਾ ਜ਼ਿਲ੍ਹੇ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਨਾ ਮੈਂ ਤੁਹਾਨੂੰ ਫੋਨ ਦੇ ਉੱਤੇ ਚੰਗੀ ਤਰ੍ਹਾਂ ਨਾਲ ਸਮਝਾ ਦੱਸ ਸਕਦਾ ਹੈਗਾ ਅਤੇ ਮੈਨੂੰ ਅ ਆਸ ਵੀ ਹੈ ਵੀ ਤੁਹਾਨੂੰ ਸਮਝ ਵੀ ਆ ਜਾਣਗੀਆਂ ਜੇ ਤੁਹਾਨੂੰ ਨਾ ਵੀ ਪਤਾ ਲੱਗਾ ਤਾਂ ਮੈਨੂੰ ਦੁਬਾਰਾ ਕਾਲ ਕਰਕੇ ਪੁੱਛ ਲਿਓ ਜਿਹੜਾ ਸਾਡਾ ਬਰ ਬਰਨਾਲਾ ਜ਼ਿਲ੍ਹਾ ਨਾ ਪੰਜਾਬ ਦਾ ਇੱਕ ਬਹੁਤ ਹੀ ਰੰਗੀਨ ਜ਼ਿਲ੍ਹਾ ਹੈਗਾ ਇੱਥੇ ਸਾਨੂੰ ਪੰਜਾਬੀਆਂ ਪੰਜਾਬੀ ਦਾ ਸੱਭਿਆਚਾਰ ਦਾ ਅਸਲੀ ਸਵਾਦ ਮਿਲਦਾ ਹੈਗਾ ਜਿਹੜੇ ਸਾਡੇ ਬਰਨਾਲੇ ਦੇ ਲੋਕ ਆ ਨਾ ਬੜੇ ਮਿਲਣਸਾਰ ਹੈ ਖੁਸ਼ ਮਿਜ਼ਾਜ ਨੇ ਅਤੇ ਇੱਥੇ ਆ ਕੇ ਤੁਸੀਂ ਇਹ ਵੀ ਦੇਖੋਗੇ ਕਿ ਵੱਖ ਵੱਖ ਧਰਮਾਂ ਦੇ ਲੋਕ ਆ ਨਾ ਸਾਰੇ ਇਕੱਠੇ ਰਹਿੰਦੇ ਨੇ ਕਿ ਕੋਈ ਐਂ ਭੇਦਭਾਵ ਨਾਲ ਨਹੀਂ ਰਹਿੰਦੇ ਵੀ ਤੇਰਾ ਧਰਮ ਇਹ ਨਹੀਂ ਸਾਰੇ ਮੇਰੇ ਵੱਲ ਮਿਲਵਰਤਨ ਦੇ ਨਾਲ ਰਹਿੰਦੇ ਨੇ ਅਤੇ ਹੋਰ ਇਥੋਂ ਦੀ ਇੱਕ ਹੋਰ ਵਧੀਆ ਗੱਲ ਹੈ ਸਾਡੇ ਬਰਨਾਲੇ ਦੀ ਜਿਹਦੇ ਸਾਨੂੰ ਕਿ ਧਾਰਮਿਕ ਸਹਿਣਸ਼ੀਲਤਾ ਦੇ ਨਾਲ ਜਾਣਿਆ ਜਾਂਦਾ ਹੈਗਾ ਜਿਹੜੇ ਸਾਡੇ ਤਿਉਹਾਰ ਆ ਇਹ ਵੀ ਬਹੁਤ ਜ਼ਿਆਦਾ ਰੰਗੀਨ ਹੁੰਦੇ ਨੇ ਇਹਨਾਂ ਦੇ ਵਿੱਚ ਅਸੀਂ ਲੋਕ ਨਾਚ ਗੀਤ ਅਤੇ ਖਾਣ ਪੀਣ ਦਾ ਅਸੀਂ ਬਹੁਤ ਜ਼ਿਆਦਾ ਆਨੰਦ ਲੈਂਦੇ ਹਾਂ ਜੇਕਰ ਕਦੇ ਨਾ ਤੁਸੀਂ ਬਰਨਾਲੇ ਆਉਂਦੇ ਹੋ ਤਾਂ ਤੁਹਾਨੂੰ ਸਾਡੇ ਪਰਿਵਾਰਕ ਮੇਲ ਜੋਲ ਸਾਡੀ ਮਿੱਠੀ ਬੋਲੀ ਦਾ ਅਨੁਭਵ ਅਸੀਂ ਤੁਹਾਨੂੰ ਜ਼ਰੂਰ ਕਰਵਾਵਾਂਗੇ ਕਿਉਂਕਿ ਜਿਹੜਾ ਸਾਡਾ ਬਰਨਾਲਾ ਜ਼ਿਲ੍ਹਾ ਨਾ ਵੀ ਬਸ ਗੱਲਾਂ ਹੀ ਛੱਡ ਦਿਓ ਜੀ ਇਹ ਇੰਨਾਂ ਖੁਬਸੂਰਤ ਜ਼ਿਲ੍ਹਾ ਹੈਗਾ ਇਹਦੀ ਆਪਣੀ ਹੀ ਵਿਲੱਖਣਤਾ ਹੈਗੀ ਇਹਦੀ ਵੀ ਜੇ ਮੈਂ ਕਹਾਂ ਮੈਂ ਤੁਹਾਨੂੰ ਦੱਸੀਆਂ ਵਾ ਇਹ ਜੇ ਉਹ ਜੇ ਤੁਸੀਂ ਇੱਥੇ ਆਉਂਗੇ ਨਾ ਤੁਹਾਨੂੰ ਇੰਨਾਂ ਘੈਂਟ ਲੱਗੇਗਾ ਇਥੋਂ ਦੇ ਲੋਕਾਂ ਦੇ ਜੀਵਨ ਸ਼ੈਲੀ ਰਿਸ਼ਤੇ ਨਾਤੇ ਕਿਵੇਂ ਨੇ ਉਹ ਨਿਭਾਉਂਦੇ ਨੇ ਇਹ ਕਿਵੇਂ ਸਾਡੇ ਤਿਉਹਾਰ ਨੇ ਕਿਹੋ ਜਿਹੇ ਸਾਡੇ ਰੀਤੀ ਰਿਵਾਜ਼ ਨੇ ਠੀਕ ਹੈ ਫਿਰ ਇੱਕ ਕਿਵੇਂ ਜੇ ਸਾਡੇ ਧਾਰਮਿਕ ਸੰਮੇਲਨ ਹੁੰਦੇ ਨੇ ਸਾਡੇ ਨਗਰ ਕੀਰਤਨ ਹੁੰਦਾ ਹੈਗਾ ਕਿਵੇਂ ਲੋਕ ਜੁੜਦੇ ਨੇ ਉਹਦੇ ਵਿੱਚ ਫਿਰ ਪ੍ਰਭਾਤ ਫੇਰੀਆਂ ਅਸੀਂ ਕੱਢਦੇ ਆਂਗੇ ਜੋ ਫਿਰ ਗੁਰੂ ਕਾ ਲੰਗਰ ਵੀ ਇੱਥੇ ਅਸੀਂ ਅਟੁੱਟ ਵਰਤਾਉਂਦੇ ਤੁਸੀਂ ਇੱਕ ਵਾਰੀ ਇੱਥੇ ਆਓ ਜ਼ਰੂਰ ਤੁਹਾਨੂੰ ਮੌਕਾ ਦੇਵਾਂਗੇ ਇੱਥੇ ਤਾਂ ਸਾਡੇ ਅਸੀਂ ਤੁਹਾਡੀ ਸੇਵਾ ਵੀ ਕਰਾਂਗੇ ਤੁਹਾਡੇ ਹੋਰ ਵੀ ਵਿਚਾਰ ਆ ਜਿਹੜੇ ਸਾਂਝੇ ਕਰਾਂਗੇ